ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਸਾਡੇ ਪੰਜਾਬ ਵਿੱਚ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਮੁੱਖ ਧਰਮ ਹੈ ਅਸੀਂ ਆਪਣੇ ਗੁਰੂਆਂ ਪੀਰਾਂ ਦੀ ਧਰਤੀ ਵਿੱਚ ਜੰਮੇ ਪਲ਼ੇ ਹਾਂ ਸਾਨੂੰ ਆਪਣੇ ਮਹਾਰਾਜ ਜੀ ਦੇ ਨਾਲ਼ ਬਹੁਤ ਜ਼ਿਆਦਾ ਲਗਨ ਹੈ ਜੇ ਅਸੀਂ ਕੋਈ ਨਸੀਬਤ ਵਿੱਚ ਵੀ ਹੋਈਏ ਤਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਤਾਂ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਆਪਣੇ ਗੁਰੂਆਂ ਪੀਰਾਂ ਦੇ ਬਹੁਤ ਸਤਿਕਾਰ ਕਰਦੇ ਹਾਂ ਜਿਨ੍ਹਾਂ ਨਾ ਕਿ ਸਾਡੇ ਲਈ ਐਨੇ ਬੜੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ ਹੈ ਆਪਣੇ ਬੱਚਿਆਂ ਨੂੰ ਵੀ ਸਾਡੇ ਲਈ ਵਾਰ ਦਿੱਤਾ ਹੈ ਅਸੀਂ ਆਪਣੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਸਤਿਕਾਰ ਕਰਦੇ ਹਨ ਅਤੇ ਜੇ ਅਸੀਂ ਗੱਲ ਕਰੀਏ ਹਿੰਦੂ ਧਰਮ ਦੀ ਤਾਂ ਉਹਦੇ ਵਿੱਚ ਆਪਣਾ ਵੇਦ ਧਰਮ ਅਤੇ ਮੁਸਲਿਮ ਦੀ ਗੱਲ ਕਰੀਏ ਤਾਂ ਕੁਰਾਨ ਅਤੇ ਮ ਆਪਣਾ ਆਪਣਾ ਸਾਈਂ ਜੀ ਦੀ ਗੱਲ ਕਰੀਏ ਤਾਂ ਬਾਈਬਲ ਵਗੈਰਾ ਦੀਆਂ ਪਾਠ ਕੀਤਾ ਜਾਂਦਾ ਹੈ ਸਾਰਿਆਂ ਨੂੰ ਆਪਣੇ ਆਪਣੇ ਗੁਰੂਆਂ ਪੀਰਾਂ ਦਾ ਬਹੁਤ ਮਾਨ ਹੈ ਕਿ ਅਸੀਂ ਉਹਨਾਂ ਦੀ ਬਾਣੀ ਪੜ੍ਹ ਕੇ ਸਾਰਿਆਂ ਨੂੰ ਬੜਾ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਮਹਾਰਾਜ ਦਾ ਬਹੁਤ ਸਤਿਕਾਰ ਕਰਦੇ ਹਨ